ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖੇਡਾਂ ਦੇ ਵਿੱਚ ਚੀਜ਼ਾਂ ਤਾਂ ਦੋ ਹੀ ਹੁੰਦੀਆਂ ਨੇ ਜਾਂ ਅਸਫਲਤਾ ਅਤੇ ਜਾਂ ਸਫਲਤਾ ਇਸ ਲਈ ਸਾਨੂੰ ਅਸਫਲਤਾ ਦੇ ਨਾਲ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਅਸਫਲਤਾ ਮਿਲੇ ਤਾਂ ਵੀ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਨੂੰ ਖੁਸ਼ ਰਹਿਣਾ ਚਾਹੀਦਾ ਏ ਤਾਂ ਕਿ ਸਾਨੂੰ ਹੋਰ ਮਿਹਨਤ ਕਰਨੀ ਚਾਹੀਦੀ ਹੈ ਜਾਂ ਕਿ ਅਸੀਂ ਅੱਗੇ ਵੱਧ ਕੇ ਹੋਰ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰੀਏ ਜਿਵੇਂ ਕਿ ਮੇਰੇ ਛੋਟੇ ਹੁੰਦੇ ਇੱਕ ਵਾਰੀ ਅਸੀਂ ਸਕੂਲ ਵਿੱਚ ਭਾਗ ਲਿਆ ਸੀ ਜਿਹਦੇ ਵਿੱਚ ਰੇਸ ਹੋਈ ਸੀ ਰੇਸ ਦੇ ਵਿੱਚ ਮੈਂ ਅਤੇ ਮੇਰੀ ਸਹੇਲੀ ਦੋਨਾਂ ਨੇ ਅਸੀਂ ਭਾਗ ਲਿਆ ਸੀ ਜਿਹਦੇ ਵਿੱਚ ਕਿ ਮੇਰੀ ਸਹੇਲੀ ਜਿੱਤ ਗਈ ਅਤੇ ਮੈਂ ਹਾਰ ਗਈ ਅਤੇ ਮੈਂ ਆਪਣਾ ਦਿਲ ਨਹੀਂ ਨਿਰਾਸ਼ ਕੀਤਾ ਮੈਂ ਹਿੰਮਤ ਰੱਖੀ ਮੈਂ ਕਿਹਾ ਨਹੀਂ ਮੈਂ ਇਸ ਵਾਰੀ ਹਾਰੀ ਹਾਂ ਅਤੇ ਅਗਲੀ ਵਾਰੀ ਮੈਂ ਜ਼ਰੂਰ ਜਿੱਤਾਂਗੀ ਜਿਹਦੇ ਨਾਲ ਕਿ ਮੈਂ ਅਗਲੀ ਵਾਰੀ ਹੋਰ ਮਿਹਨਤ ਕੀਤੀ ਦਿਨ ਰਾਤ ਮੈਂ ਮਿਹਨਤ ਕੀਤੀ ਅਤੇ ਮੈਂ ਫਿਰ ਜਦੋਂ ਸਾਡੇ ਸਕੂਲ ਵਿੱਚ ਅਗਲੀ ਵਾਰੀ ਅਗਲੇ ਸਾਲ ਜਦੋਂ ਇਹ ਗੇਮ ਹੋਈ ਅਤੇ ਮੈਂ ਇਹਦੇ ਵਿੱਚ ਭਾਗ ਲਿਆ ਜਿਹਦੇ ਵਿੱਚ ਕਿ ਮੈਂ ਜਿੱਤ ਗਈ ਮੈਂ ਜਿੱਤ ਗਈ ਅਤੇ ਮੈਂ ਬਹੁਤ ਖੁਸ਼ ਹੋਈ ਅਤੇ ਮੈਂ ਆਪਣੇ ਉੱਤੇ ਬਹੁਤ ਮਾਣ ਅਤੇ ਗਰਵ ਮਹਿਸੂਸ ਕੀਤਾ ਕਿ ਮੈਂ ਇਸ ਵਾਰੀ ਜਿੱਤ ਕੇ ਮਿਹਨਤ ਕਰਕੇ ਦਿਨ ਰਾਤ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਹ ਤੋਂ ਇਹੀ ਸਾਨੂੰ ਸ਼ਿਕਸ਼ਾ ਮਿਲਦੀ ਹੈ ਕਿ ਜੇ ਅਸੀਂ ਹਾਰ ਵੀ ਜਾਂਦੇ ਹਾਂ ਖੇਡਦੇ ਹਾਂ ਗੇਮ ਵਿੱਚ ਤਾਂ ਸਾਨੂੰ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਫਲਤਾ ਅਤੇ ਅਸਫਲਤਾ ਇਹ ਤਾਂ ਦੋ ਹੀ ਪੱਧਰ ਨੇ ਜਿਹਦੇ ਤੋਂ ਸਾਨੂੰ ਇੱਕ ਤਾਂ ਸਹਿਣਾ ਹੀ ਪੈਣਾ ਵਾ ਇਹਦੇ ਤੋਂ ਸਾਨੂੰ ਇਹ ਸਿਕਸ਼ਾ ਮਿਲਦੀ ਹੈ ਕਿ ਜੇ ਅਸੀਂ ਅਸਫਲਤਾ ਪ੍ਰਾਪਤ ਕਰਦੇ ਤਾਂ ਤਾਂ ਸਾਨੂੰ ਹੋਰ ਮਿਹਨਤ ਕਰਨੀ ਚਾਹੀਦੀ ਜਿਹਦੇ ਨਾਲ ਕਿ ਅਸੀਂ ਸਫ਼ਲ ਹੋ ਸਕੀਏ ਜਿਹਦੇ ਨਾਲ ਕਿ ਮੈਂ ਆਪਣੀ ਦਿਨ ਰਾਤ ਮਿਹਨਤ ਕਰਕੇ ਅਤੇ ਆਪਣੀ ਸਫਲਤਾ ਪ੍ਰਾਪਤ ਕੀਤੀ ਜਿਹਦੇ ਨਾਲ ਕਿ ਮੈਂ ਜਿੱਤ ਗਈ ਧੰਨਵਾਦ ਜੀ